ਅੱਜ ਟੈਕਨੋਲਜੀ ਦਾ ਯੁੱਗ ਹੋਣ ਕਾਰਨ ਟੈਕਨੋਲੋਜੀ ਨੇ ਸਾਡੇ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਤਰੀਕਿਆਂ ਨੂੰ ਕਈ ਤਰੀਕਿਆਂ ਨਾਲ ਬਦਲ ਕੇ ਰੱਖਤਾ ਰੱਖ ਦਿੱਤਾ ਹੈ ਜਿਵੇਂ ਕਿ ਪਹਿਲਾਂ ਦੇ ਲੋਕ ਆਪਸ ਵਿੱਚ ਗੱਲ ਕਰਨ ਲਈ ਬੈਠਕਾਂ ਬੁਲਾਉਂਦੇ ਹੁੰਦੇ ਸੀ ਪਰ ਅੱਜ ਕੱਲ੍ਹ ਇਹ ਸਭ ਕੰਮ ਟੈਕਨੋਲੋਜੀ ਦਾ ਦੌਰ ਹੋਣ ਕਾਰਨ ਆਪਸ ਵਿੱਚ ਵੀਡੀਓ ਕਾਲ ਰਾਹੀਂ ਗੱਲ ਕਰਕੇ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਦੂਜੇ ਵਿਚਾਰਾਂ ਦੂਜੇ ਲੋਕਾਂ ਦੇ ਵਿਚਾਰਾਂ ਨੂੰ ਸਮਝਦੇ ਹਨ ਇਹ ਗੱਲਬਾਤ ਜਿਵੇਂ ਕਿ ਜੂਮ ਐਪ ਵਟਸਐਪ 'ਤੇ ਕੋਲਿੰਗ ਵੀਡੀਓ ਕੋਲਿੰਗ ਕਰਕੇ ਇਕ ਦੂਜੇ ਦੇ ਵਿਚਾਰਾਂ ਨੂੰ ਸਮਝ ਸਕਦੇ ਹਾਂ